ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਜਿਵੇਂ ਕਿ ਆਪਾਂ ਇੱਕ ਸਰਜਰੀ ਕਰਵਾਉਣਾ ਚਾਹੁੰਦੇ ਹਾਂ ਉਹਦੇ ਬਾਰੇ ਬੀਮਾ ਪ੍ਰਦਾਤਾ ਨੂੰ ਕੌਲ ਦੇ ਉੱਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਇੱਕ ਸਰਜਰੀ ਕਰਵਾਉਣ ਬਾਰੇ ਸੋਚ ਰਿਹਾ ਸੀ ਮੇਰੇ ਸਰੀਰ ਦੇ ਵਿੱਚ ਜਿਵੇਂ ਕਿ ਉਹ ਸਰਜਰੀ ਮੈਂ ਆਪਣੇ ਫੇਸ ਦੇ ਉੱਤੇ ਕਰਵਾਉਣੀ ਚਾਹੁੰਦਾ ਸੀਗਾ ਮੇਰੇ ਆਈ ਸਰਜਰੀ ਕਰਵਾਉਣਾ ਚਾਹੁੰਦਾ ਸੀ ਮੈਂ ਜਿਹਦੇ ਕਰਕੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਸਰਜਰੀ ਕਿਸ ਤਰ੍ਹਾਂ ਹੋ ਸਕਦੀ ਹੈ ਅਤੇ ਇਸ ਇਹ ਸਰਜਰੀ ਦੀ ਪ੍ਰਕਿਰਿਆ ਕਿਸ ਤਰ੍ਹਾਂ ਹੈ ਇਸ ਦੇ ਉੱਤੇ ਖ ਇਸ ਦੇ ਉੱਤੇ ਹੋਣ ਵਾਲੇ ਖਰਚੇ ਬਾਰੇ ਅਤੇ ਇਸ ਦੀ ਪ੍ਰਕਿਰਿਆ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਅਤੇ ਮੈਨੂੰ ਉਮੀਦ ਆ ਤੁਸੀਂ ਸਰ ਮੈਨੂੰ ਦੱਸਣ ਦੀ ਕਿਰਪਾ ਕਰੋਗੇ ਵੀ ਕਿਸ ਤਰ੍ਹਾਂ ਹੋਵੇਗੀ ਕਿੰਨਾ ਇਸ ਉੱਤੇ ਖਰਚਾ ਆਵੇਗਾ ਕਿਸ ਹਸਪਤਾਲ ਵਿੱਚ ਵੱਧ ਤੋਂ ਵੱਧ ਬਹੁਤ ਵਧੀਆ ਤਰੀਕੇ ਨਾ ਹੋ ਸਕਦੀ ਹੈ ਕਿਸ ਡਾਕਟਰ ਦੇ ਕੋਲ ਜਾਂ ਬਹੁਤ ਚੰਗੇ ਤਰੀਕੇ ਨਾਲ ਹੋ ਸਕਦੀ ਆ ਕਿੰਨੇ ਮਹੀਨਿਆਂ ਦਾ ਮੈਨੂੰ ਆਰਾਮ ਦੀ ਜ਼ਰੂਰਤ ਹੈ ਅਤੇ ਕਿਸ ਤਰ੍ਹਾਂ ਮੈਨੂੰ ਇਹ ਸਰਜਰੀ ਕਰਵਾਈ ਜਾਵੇਗੀ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਆਪ ਜੀ ਦਾ ਧੰਨਵਾਦੀ